ਸਾਡੇ ਪੌਦਿਆਂ ਦੀ ਦੇਖਭਾਲ ਸਾਡਾ ਘਰ ਦਾ ਮਾਲੀ ਕਰਦਾ ਹੈ ਕਿਉਂਕਿ ਅਸੀਂ ਜਦੋਂ ਵੀ ਬਾਹਰ ਜਾਣਾ ਹੁੰਦਾ ਹੈ ਉਦੋਂ ਅਸੀਂ ਮਾਲੀ ਨੂੰ ਪੌਦੇ ਸੌਂਪ ਕੇ ਚਲ ਵੀ ਜਾਂਦੇ ਹਾਂ ਬਾਹਰ ਮਗਰੋਂ ਸਾਡਾ ਘਰ ਦਾ ਮਾਲੀ ਹੀ ਪੌਦਿਆਂ ਦੀ ਦੇਖਭਾਲ ਕਰਦਾ ਹੈ